ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਮੈਨੂੰ ਗਾ ਐਜ਼ ਏ ਗਾਈਡ ਵੀ ਹਾਇਰ ਕਰਨਾ ਜੀ ਮੈਨੂੰ ਨਾਲ ਲੈ ਕੇ ਜਾਣਾ ਠੀਕ ਹੈ ਜੀ ਮੇਰੇ ਨਾ ਸੱਤ ਸੌ ਰੁਪਈਆ ਚਾਰਜਿਸ ਹੋਣਗੇ ਜੀ ਉਹਦੇ ਵਿੱਚ ਮੈਂ ਤੁਹਾਨੂੰ ਹਾਂਜੀ ਹਾਂਜੀ ਪਰ ਡੇਅ ਅਤੇ ਮੈਂ ਤੁਹਾਨੂੰ ਉਹਦੇ ਵਿੱਚ ਆਪਣਾ ਘੁਮਾਵਾਂਗਾ ਸਟੇਟ ਗੁਰਦੁਆਰਾ ਸਾਹਿਬ ਉਹਦਾ ਇਤਿਹਾਸ ਦੱਸਾਂਗਾ ਉਹ ਜੋ ਸ਼ਹਿਰ ਦੇ ਵਿਚਕਾਰ ਆ ਇਸ ਤੋਂ ਇਲਾਵਾ ਇੱਥੇ ਪੰਚ ਮੰਦਿਰ ਬਹੁਤ ਮਸ਼ਹੂਰ ਆ ਅਤੇ ਇਸ ਤੋਂ ਬਾਅਦ ਇੱਕ ਕਾਲੀ ਮਾਤਾ ਦਾ ਮੰਦਰ ਭੱਦਰ ਕਾਲੀ ਉੱਥੇ ਵੀ ਇੱਕ ਮੇਲਾ ਲੱਗਦਾ ਉਹਦੇ ਬਾਰੇ ਵੀ ਤੁਹਾਨੂੰ ਮੈਂ ਘੁਮਾਵਾਂਗੇ ਇਸ ਤੋਂ ਬਾਅਦ ਸ਼ਹਿਰ 'ਚੋਂ ਥੋੜ੍ਹਾ ਬਾਹਰ ਬਾਹਰ ਜਿੱਦਾਂ ਹੈ ਨਾ ਇਤਿਹਾਸਿਕ ਸਥਾਨ ਵੀ ਹਨ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਟਾਹਲੀ ਸਾਹਿਬ ਵੀ ਜਿੱਥੇ ਉਨ੍ਹਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਉੱਥੇ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਜੀ ਅਤੇ ਤੁਸੀਂ ਅੱਜ ਆਏ ਹੋਏ ਆ ਕਪੂਰਥਲੇ ਆਏ ਆਂ

ਠੀਕ ਹੈ ਜੀ ਠੀਕ ਹੈ ਜੀ ਮੈਂ ਤੁਹਾਨੂੰ ਅ ਵੱਟਸਅੱਪ 'ਤੇ ਭੇਜ ਦਿੰਨਾ ਤੁਹਾਡੇ ਕੋਲ ਗੱਡੀ ਹੈਗੀ ਆਪਣੀ ਜੀ ਚਲੋ ਠੀਕ ਹੈ ਜੀ ਅਤੇ ਤੁਸੀਂ ਮੈਂ ਤੁਹਨੂੰ ਵਟਸਐਪ 'ਤੇ ਲੋਕੇਸ਼ਨ ਭੇਜ ਦਿੰਦਾ ਤਾਂ ਤੁਸੀਂ ਆ ਜਾਓ ਅਤੇ ਮੈਂ ਤੁਹਾਡੇ ਨਾਲ ਚੱਲ ਕੇ ਤੇ ਤੁਹਾਨੂੰ ਇਹਦੇ ਬਾਰੇ ਸਾਰੇ ਇਤਿਹਾਸ ਬਾਰੇ ਅਤੇ ਇਹਦੇ ਸੱਭਿਆਚਾਰ ਬਾਰੇ ਜਾਣੂ ਕਰਵਾਵਾਂਗਾ ਜੀ ਓਕੇ ਜੀ ਧੰਨਵਾਦ